ਮੈਨੂੰ ਘਰ ਕਾਰ ਸਿੱਖਿਆ ਲਈ ਕਰਜ਼ੇ ਦੀ ਜ਼ਰੂਰਤ ਸੀ ਇਹ ਕਰਜ਼ਾ ਲੈਣ ਲਈ ਮੈਂ ਬੈਂਕ ਕੋਲ ਗਈ ਮੈਨੇ ਬੈਂਕ 'ਚ ਜਾ ਕੇ ਪਹਿਲਾਂ ਕਰਜ਼ੇ ਦੀ ਪੂਰੀ ਜਾਣਕਾਰੀ ਲਈ ਮੈਨੇ ਬੈਂਕ 'ਚ ਜਾ ਕੇ ਪੁੱਛਿਆ ਵੀ ਉਹ ਕਿੰਨੇ ਪ੍ਰਤੀਸ਼ਤ ਦਰ 'ਤੇ ਕਰਜ਼ਾ ਦਿੰਦੇ ਹਨ ਅਤੇ ਕਰਜ਼ੇ ਲਈ ਕੀ ਚੀਜ਼ ਗਿਰਵੀ ਰਖਵਾਉਂਦੇ ਹਨ ਫਿਰ ਮੈਨੇ ਘਰ ਆ ਕੇ ਘਰਦਿਆਂ ਨਾਲ ਸਲਾਹ ਕੀਤੀ ਅਤੇ ਅਗਲੇ ਦਿਨ ਮੈਂ ਆਪਣੀ ਜ਼ਮੀਨ ਦੇ ਕਾਗਜ਼ ਲੈ ਕੇ ਬੈਂਕ 'ਚ ਚਲੀ ਗਈ ਮੈਨੇ ਬੈਂਕ ਤੋਂ ਦੋ ਸਾਲਾਂ ਲਈ ਘਰ ਕਾਰ ਸਿੱਖਿਆ ਲਈ ਕਰਜ਼ਾ ਲਿਆ ਸੀ ਅਤੇ ਕਰਜ਼ੇ ਦੀ ਦਰ ਸੱਤ ਪ੍ਰਤੀਸ਼ਤ ਸੀ ਇਸ ਕਰਜ਼ੇ ਨਾਲ ਮੈਨੂੰ ਹਰ ਚੀਜ਼ ਹਰ ਸਹੂਲਤ ਪੂਰੀ ਕਰ ਲਈ ਸੀ ਇਸ ਤਰ੍ਹਾਂ ਮੈਨੇ ਇੱਕ ਸਾਲ ਤੋਂ ਬਾਅਦ ਸੱਤ ਪ੍ਰਤੀਸ਼ਤ ਦਰ 'ਤੇ ਕਰਜ਼ਾ ਬੈਂਕ ਨੂੰ ਵਾਪਸ ਕਰ ਦਿੱਤਾ ਸੀ ਇਸ ਤਰ੍ਹਾਂ ਮੈਨੇ ਆਪਣੀ ਸਾਰੀ ਜ਼ਰੂਰਤ ਨੂੰ ਪੂਰਾ ਕਰ ਲਿਆ ਸੀ